ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਹੈਗਾ ਪਠਾਨਕੋਟ ਅਤੇ ਸ਼ਹਿਰ ਪਠਾਨਕੋਟ ਹੈਗਾ ਅਤੇ ਅਕਸਰ ਸਾਡੇ ਜਿਹੜੇ ਲਾਗੇ ਪਿੰਡਾਂ ਦੇ ਵਿੱਚ ਹੈਗਾ ਵਿਆਹ ਅੱਜ ਕੱਲ੍ਹ ਇੱਕ ਕਹਿ ਲਓ ਮਾਡਰਨ ਜਾਂ ਨਵਾਂ ਜਮਾਨਾ ਆ ਗਿਆ ਹੈ ਜਿਸ ਵਿੱਚ ਕਿ ਅੱਜ ਕੱਲ੍ਹ ਵਿਆਹ ਹੁੰਦੇ ਆ ਪੈਲਸਾਂ ਦੇ ਵਿੱਚ ਠੀਕ ਹੈ ਪਹਿਲਾਂ ਵਿਆਹ ਹੁੰਦੇ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਖੁੱਲ੍ਹੀ ਜਗ੍ਹਾ ਦੇ ਵਿੱਚ ਕਿਸੇ ਨੇ ਅਰੇਂਜ ਕਰ ਲੈਣਾ ਜਾਂ ਜੰਝ ਘਰਾਂ ਦੇ ਵਿੱਚ ਕਿਸੇ ਨੇ ਰੱਖ ਲੈਣਾ ਹੈ ਨਾ ਪ੍ਰਬੰਧ ਕਰ ਲੈਣਾ ਉੱਥੇ ਹੀ ਵਿਆਹ ਕਰ ਲੈਣੇ ਪਰ ਅੱਜ ਦੇ ਜਮਾਨੇ ਦੇ ਵਿੱਚ ਲੋਕ ਜਿਹੜਾ ਹੈਗਾ ਉਹ ਜ਼ਿਆਦਾ ਆਪਣਾ ਸਟੈਂਡਰਡ ਵੇਖਦੇ ਆ ਜਾਂ ਹੈ ਨਾ ਫਸਿਲਿਟੀ ਜ਼ਿਆਦਾ ਹੋ ਗਈ ਆ ਅਤੇ ਅੱਜ ਕੱਲ੍ਹ ਲੋਕ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਦੇ ਆ ਸਾਡੇ ਪਿੰਡ ਵਿੱਚ ਵੀ ਜਿਹੜਾ ਅੱਜ ਕੱਲ੍ਹ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਵਿਆਹ ਤੋਂ ਪਹਿਲਾਂ ਮੁਲਾਕਾਤ ਅੱਜ ਕੱਲ੍ਹ ਹੁੰਦੀ ਹੈ ਕਿ ਪਹਿਲਾਂ ਮੁੰਡੇ ਦੀ ਵੇ ਮੁੰਡੇ ਅਤੇ ਕੁੜੀ ਦੀ ਵੇਖ ਵਿਖਾਈ ਕੀਤੀ ਜਾਂਦੀ ਹੈ ਠੀਕ ਆ ਉਹ ਵੇਖ ਵਿਖਾਈ ਜੇ ਤਾਂ ਦੋਨਾਂ ਪਰਿਵਾਰਾਂ ਨੂੰ ਉਹਦੀ ਸਹਿਮਤੀ ਹੈ ਉਸ ਤੋਂ ਬਾਅਦ ਹੀ ਜਿਹੜੀ ਹੈ ਇੱਕ ਉਹਨਾਂ ਦੀ ਮੀਟਿੰਗ ਰੱਖੀ ਜਾਂਦੀ ਹੈ ਜਾਂ ਕਹਿ ਲਓ ਮੁਲਾਕਾਤ ਰੱਖੀ ਜਾਂਦੀ ਉਹਦਾ ਪ੍ਰਬੰਧ ਕੀਤਾ ਜਾਂਦਾ ਉਹ ਕਿਸੇ ਵੀ ਕਿਸੇ ਰਿਸ਼ਤੇਦਾਰ ਦੇ ਘਰ ਹੋ ਸਕਦੀ ਆ ਆਪ ਦੇ ਦੋਨੋਂ ਘਰ ਛੱਡ ਕੇ ਉਹ ਕਿਸੇ ਵੀ ਹੋਰ ਰਿਸ਼ਤੇਦਾਰ ਦੇ ਘਰ ਰੱਖੀ ਜਾ ਸਕਦੀ ਹੈ ਮੀਟਿੰਗ ਜਾਂ ਕਿਸੇ ਵੀ ਇੱਕ ਛੋਟੇ ਮੋਟੇ ਜਿਹੜਾ ਹੈਗਾ ਰੈਸਟੋਰੈਂਟ ਜਾਂ ਹੋਟਲ ਦੇ ਵਿੱਚ ਮੀਟਿੰਗ ਰੱਖੀ ਜਾ ਸਕਦੀ ਹੈ ਜੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਹੈ ਤਾਂ ਉੱਥੇ ਹੀ ਉਹਨਾਂ ਨੂੰ ਮੁੰਡੇ ਵਾਲੇ ਅਤੇ ਕੁੜੀ ਵਾਲੇ ਜਿਹੜਾ ਹੈਗਾ ਦੋਵਾਂ ਨੂੰ ਇੱਕ ਕਹਿ ਲਓ ਸ਼ਗਨ ਦੇ ਤੌਰ 'ਤੇ ਜਾਂ ਰੋਕ ਲੈਂਦੇ ਆ ਮੁੰਡੇ ਕੁੜੀ ਨੂੰ ਇੱਕ ਹਿਸਾਬ ਦਾ ਰੋਕਾ ਕਹਿ ਦਿੰਦੇ ਆ ਕਿ ਰੋਕ ਲੈਂਦੇ ਆ ਕਿ ਹੁਣ ਇਹਨਾਂ ਦਾ ਰਿਸ਼ਤਾ ਜਿਹੜਾ ਉਹ ਪੱਕਾ ਹੋ ਗਿਆ ਕਿ ਨਾ ਕੁੜੀ ਕਿਤੇ ਹੋਰ ਆਪਣਾ ਰਿਸ਼ਤਾ ਕਰ ਸਕਦੇ ਆ ਅਤੇ ਨਾ ਮੁੰਡਾ ਕਿਤੇ ਹੋਰ ਅਤੇ ਉਸ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਉਹ ਇੱਕ ਦੂਜੇ ਨੂੰ ਜਾਂ ਇੱਕ ਲੱਡੂਆਂ ਦਾ ਡੱਬਾ ਦੇ ਲੈਂਦੇ ਆ ਅਤੇ ਇੱਕ ਜੋ ਵੀ ਮਾਂ ਪਿਓ ਹੈਗਾ ਉਹ ਇੱਕ ਦੂਜੇ ਨੂੰ ਸ਼ਗਨ ਦੇ ਕੇ ਇੱਕ ਤਰ੍ਹਾਂ ਦਾ ਆਪਣਾ ਵਿਆਹ ਦਾ ਜਾਂ ਫਿਕਸ ਕਰ ਲੈਂਦੇ ਆ ਕਿ ਹਾਂ ਕਿ ਹੁਣ ਸਾਡਾ ਹੀ ਵਿਆਹ ਦੀ ਜਿਹੜਾ ਹੈਗਾ ਆਪਾਂ ਇਹ ਮੁੰਡੇ ਕੁੜੀ ਲਈ ਦੋਵੇਂ ਹੀ ਸਹਿਮਤ ਹੈਗੇ ਹਾਂ ਅਤੇ ਵਿਆਹ ਦੀ ਤਿਆਰੀ ਕੀਤੀ ਜਾ ਸਕਦੀ ਹੈ